ਹੈਲੋ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਸਰ ਠੀਕ ਹੈ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਬਾਈ ਜੀ ਉਹਦੇ ਵਾਸਤੇ ਨਾ ਤੁਹਾਨੂੰ ਅਤੇ ਜਿਵੇਂ ਮੰਨ ਲਉ ਤੁਹਾਡਾ ਐਡਰੈਸ ਵੀ ਦਿੱਲੀ ਦੀ ਹੋਣਾ ਜੀ ਉਹਦੇ ਲਈ ਨਾ ਤੁਹਾਨੂੰ ਭਾਅ ਜੀ ਇੱਕ ਤਾਂ ਆਪਣਾ ਜਿਵੇਂ ਤੁਹਾਡਾ ਦਿੱਲੀ ਆਰ ਟੀ ਓ ਆਫਿਸ ਆ ਜਿੱਥੇ ਤੁਹਾਡਾ ਹੈਗਾ ਉੱਥੇ ਨਾ ਤੁਹਾਨੂੰ ਐੱਨ ਓ ਸੀ ਅਪਲਾਈ ਕਰਨਾ ਪਊਗਾ ਉਹਨਾਂ ਕੋਲ ਜਾ ਕੇ ਨਾ ਇੱਕ ਪਰਿਵਾਹਨ ਨਾ ਐਪ ਆਉਂਦੀ ਹੈ ਇੱਕ ਇੰਨਾ ਦੀ ਹਾਂ ਉਸ ਤੇ ਤੁਹਾਡੇ ਸਾਰੀ ਡਿਟੇਲ ਉੱਥੇ ਭਰਨੀ ਪਊਗੀ ਤੁਹਾਨੂੰ ਕਿ ਉਹਦੇ 'ਚ ਰੀਜ਼ਨ ਦੇ ਕੇ ਕੀ ਮੇਰਾ ਆਪਣਾ ਲਾ ਕੇ ਮਤਲਬ ਪਰੂਫ ਲਾ ਕੇ ਕਿ ਮ ਮੇਰੀ ਜੋਬ ਇੱਥੇ ਆ ਗਈ ਪੰਜਾਬ ਦੇ ਵਿੱਚ ਫਿਰ ਉਹ ਤੁਹਾਨੂੰ ਉਹਦੀ ਫੀਸ ਹੁੰਦੀ ਆ ਕੋਈ ਐੱਨ ਓ ਸੀ ਵਗੈਰਾ ਦੀ ਉਹ ਤੁਹਾਨੂੰ ਐੱਨ ਓ ਸੀ ਦੀ ਫੀਸ ਵਗੈਰਾ ਦੱਸ ਕੇ ਉਸਤੋਂ ਬਾਅਦ ਤੁਸੀਂ ਡਾਕੂਮੈਂਟ ਨਾਲ ਲਾ ਕੇ ਆਪਣੇ ਆਰ ਸੀ ਦੇ ਉਹਦੇ 'ਚ ਇਨਸ਼ੋਰੈਂਸ ਲਾ ਕੇ ਅਤੇ ਫਿਰ ਉਸ ਤੋਂ ਬਾਅਦ ਤੁਸੀਂ ਐੱਨ ਓ ਸੀ ਮਿਲੂਗੀ ਤੁਹਾਨੂੰ ਤੇ ਜਦੋਂ ਭਾਅ ਜੀ ਤੁਹਾਡੀ ਐੱਨ ਓ ਸੀ ਆ ਗਈ ਉਹ ਪੰਦਰਾਂ ਵੀਹ ਦਿਨ ਜਦੋਂ ਉਹਦਾ ਪ੍ਰੋਸੈਸ ਹੁੰਦਾ ਉਹ ਥੋਡੇ ਕੋਲ ਘਰ ਆ ਜੂਗੀ ਜਾਂ ਤੁਸੀਂ ਡੀਲਰ ਥਰੂ ਕਰੋਗੇ ਉਹ ਤੁਹਾਨੂੰ ਦੇ ਦੂਗਾ ਉਸਤੋਂ ਬਾਅਦ ਉਹ ਡਾਕੂਮੈਂਟ ਲਾ ਕੇ ਤੁਸੀਂ ਪੰਜਾਬ ਦੇ ਵਿੱਚ ਜਿਵੇਂ ਮੰਨ ਲਓ ਜੇ ਤੁਸੀਂ ਪਟਿਆਲੇ ਦੀ ਐੱਨ ਓ ਸੀ ਲੈਣੀ ਤਾਂ ਪਟਿਆਲੇ ਦਾ ਪਾਉਣਾ ਪਊਗਾ ਥੋਨੂੰ ਉਹਦੇ ਵਿੱਚ ਪੰਜਾਬ ਪਟਿਆਲਾ ਉੱਥੇ ਫਿਰ ਜਿਹੜਾ ਪਟਿਆਲੇ ਦਾ ਆਰ ਟੀ ਓ ਆਫਿਸ ਹੁੰਦਾ ਤਾਂ ਸਾਡੇ ਨਾਲ ਤੁਸੀਂ ਫਿਰ ਸੰਪਰਕ ਕਰ ਲੈਣਾ ਉਹਦੇ ਲਈ ਤੁਹਾਨੂੰ ਹੈਂ ਜੀ ਹਾਂਜੀ ਹਾਂ ਬਾਈ ਜੀ ਫੀਸ ਇਹਦੀ ਦੇਖੋ ਐੱਨ ਓ ਸੀ ਵਾਸਤੇ ਵੀ ਫੀਸ ਹੋਊਗੀ ਤੁਹਾਡੀ ਫਿਰ ਜੇ ਤੁਸੀਂ ਪੰਜਾਬ ਦੇ ਵਿੱਚ ਨਾਮ ਆ ਕਰਾਉਣੀ ਆ ਫਿਰ ਉਹਦੀ ਵੀ ਅੱਡ ਫੀਸ ਹੋਊਗੀ ਜੀ ਸਰ ਹਾਂਜੀ ਹਾਂ ਇਹ ਜ ਆਪਣਾ ਊਂ ਤਾਂ ਤੁਸੀਂ ਚਲਾ ਸਕਦੇ ਹੋ ਗੱਡੀ ਪਰ ਫਿਰ ਜਦੋਂ ਮ ਇੱਥੇ ਆ ਕੇ ਫਿਰ ਇਥੋਂ ਦੀ ਤੁਹਾਨੂੰ ਐੱਨ ਓ ਸੀ ਲੈਣੀ ਪੈਂਦੀ ਹੈ ਹਾਂਜੀ ਹਾਂ ਤੁਸੀਂ ਦਿੱਲੀ ਵਾਲਾ ਪ੍ਰੋਸੈਸ ਪੂਰਾ ਕਰਕੇ ਹਾਂਜੀ ਹਾਂ ਹਾਂਜੀ ਹਾਂ ਉਸ ਤੋਂ ਪਹਿਲਾਂ ਆਪਣਾ ਪੋਲਿਊਸ਼ਨ ਦਾ ਅਤੇ ਆਪਣਾ ਇੰਸ਼ੋਰੈਂਸ ਵਗੈਰਾ ਜ਼ਰੂਰ ਚੈੱਕ ਕਰ ਲਿਓ ਠੀਕ ਹੈ ਬਾਈ ਜੀ ਓਕੇ ਜੀ ਬਾਈ ਜੀ